ਹਾਂਜੀ ਟੈਕਨੋਲੋਜੀ ਨੇ ਸਾਡੇ ਖੇਤਰ ਦੇ ਵਿੱਚ ਵੱਖ ਵੱਖ ਭਾਈਚਾਰੇ ਵਿੱਚ ਏਕਤਾ ਲਿਆਉਣ ਦਾ ਬਹੁਤ ਜ਼ਿਆਦਾ ਕੰਮ ਕੀਤਾ ਹੈ ਇਸ ਨਾਲ ਅਸੀਂ ਦੂਰ ਦੁਰਾਡੇ ਬੈਠੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਉਹਨਾਂ ਨੂੰ ਦੇਖ ਸਕਦੇ ਹਾਂ ਉਹਨਾਂ ਨਾਲ ਮਿਲ ਸਕਦੇ ਹਾਂ ਵੀਡੀਓ ਕਾਲ ਦੇ ਜ਼ਰੀਏ ਇਸ ਨਾਲ ਸਾਡੀ ਬਹੁਤ ਇਸ ਨਾਲ ਸਾਡਾ ਸਮਾਂ ਬਹੁਤ ਜ਼ਿਆਦਾ ਬਚਦਾ ਹੈ ਇਹ ਯੇ ਇਹ ਭਾਈਚਾਰੇ ਲਈ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਦਾ ਵੀ ਕੰਮ ਕਰਦੇ ਹਨ ਕਿਉਂਕਿ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਦਾ ਗਲਤ ਉਪਯੋਗ ਕੀਤਾ ਹੈ ਜੋ ਕਿਸੇ ਦੀ ਗਲਤ ਫੋਟੋਆਂ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਹਨ ਅਤੇ ਬਾਅਦ ਵਿੱਚ ਉਸਨੂੰ ਬਹੁਤ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਇਹ ਇਸਦੇ ਟੈਕਨੋਲੋਜੀ ਦੇ ਫ਼ਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ ਦੋਨੋਂ ਕੰਮ ਹੀ ਹਨ